ਪੰਜਾਬੀ ਭਾਸ਼ਾ ਸਭ ਤੋਂ ਵੱਧ ਪ੍ਰਭਾਵਿਤ ਹੈ ਘਰ ਦੇ ਵਿੱਚੋਂ ਹੀ ਸਟਾਰਟ ਹੋਈ ਹੈ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਮਾਂ ਬੋਲੀ ਹੈ ਪਰ ਅਸੀਂ ਆਪਣੇ ਬੱਚੇ ਅੱਜ ਕੱਲ੍ਹ ਇੰਗਲਿਸ਼ ਸਕੂਲਾਂ ਵਿੱਚ ਪਾਉਂਦੇ ਹਾਂ ਅਤੇ ਇੰਗਲਿਸ਼ ਸਕੂਲਾਂ ਦੇ ਵਿੱਚ ਮੈਡਮਾਂ ਇੰਗਲਿਸ਼ ਹੀ ਬੋਲਦੀਆਂ ਜਦੋਂ ਬੱਚੇ ਘਰ ਆਉਂਦੇ ਹਨ ਤਾਂ ਅਸੀਂ ਕਹਿੰਦੇ ਅਰੇ ਬੇਟਾ ਐਸੇ ਨਹੀਂ ਐਸੇ ਐਸੇ ਕਰਨਾ ਐਸੇ ਕਰਨਾ ਤੋਂ ਪੰਜਾਬੀ ਭਾਸ਼ਾ ਉਹ ਵੀ ਪ੍ਰਭਾਵਿਤ ਹੋਈ ਕਿਉਂਕਿ ਮਾਂ ਵੀ ਆਪਣੀ ਭਾਸ਼ਾ ਭੁੱਲ ਜਾਂਦੀ ਹੈ ਇੱਕ ਅਕਸਰ ਅਸੀਂ ਬਈਏ ਵਾਲੀ ਭਾਸ਼ਾ ਬੋਲਣੀ ਸ਼ੁਰੂ ਕਰਤੀ ਵਿੱਚੇ ਹਿੰਦੀ ਵਿੱਚੇ ਪੰਜਾਬੀ ਵਿੱਚੇ ਅਸੀਂ ਇੰਗਲਿਸ਼ ਬੋਲਦੇ ਹਾਂ ਅਤੇ ਇ ਇਹ ਜਿਹੜੇ ਪੰਜਾਬੀ ਦੇ ਦਫ਼ਤਰ ਹਨ ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਾ ਲਉ ਇੱਥੇ ਵੀ ਚਲੋ ਅਕਸਰ ਆਪਾਂ ਪੰਜਾਬੀ ਤਾਂ ਬੋਲਦੇ ਹਾਂ ਪਰ ਸਾਡੀ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਅਪਲਾਈ ਤਾਂ ਨਹੀਂ ਹੋ ਰਹੀ ਪਰ ਸਾਨੂੰ ਕੀ ਹੈ ਇਹਦੇ 'ਚ ਜਿਹੜੀ ਬੋਲਚਾਲ ਦੀ ਬੋਲੀ ਹੈ ਇਹ ਵੀ ਸਾਡੀ ਸੁਧਾਰ ਲਿਆਉਣਾ ਚਾਹੀਦਾ ਬਾਕੀ ਫਾਰਮ ਵਗੈਰਾ ਜੋ ਵੀ ਲਿਖਤ ਪੜ੍ਹਤ ਆ ਸਾਰੀ ਪੰਜਾਬੀ 'ਚ ਹੀ ਹੋਣੀ ਕੰਪਲਸਰੀ ਹੋਣੀ ਚਾਹੀਦੀ ਔਰ ਸਕੂਲ ਦੇ ਵਿੱਚ ਵੀ ਇੱਕ ਇਹ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਹੀ ਬੋਲੀਏ ਟੀਚਰ ਵੀ ਪੰਜਾਬੀ ਬੋਲਣ ਬੱਚੇ ਵੀ ਪੰਜਾਬੀ ਬੋਲਣ ਤਾਂ ਹੀ ਸਾਡੀ ਇਹ ਪੰਜਾਬੀ ਭਾਸ਼ਾ ਜਿਹੜਾ ਯੋਗਦਾਨ ਹੈਗਾ ਵੱਧ ਤੋਂ ਵੱਧ ਵਧੇਗਾ ਅਤੇ ਪੰਜਾਬੀ ਭਾਸ਼ਾ ਪ੍ਰਫੁੱਲਿਤ ਹੋਵੇਗੀ